ਦੇਖੋ ਪੰਜਾਬ ਦੇ ਵਿੱਚ ਤਾਂ ਹਰ ਤਰ੍ਹਾਂ ਦੀ ਬਿਮਾਰੀ ਦਾ ਘਰੇਲੂ ਇਲਾਜ ਹੈ ਚਾਹੇ ਉਹ ਕੋਈ ਵੀ ਹੋਵੇ ਅਤੇ ਬਾਕੀ ਜੇ ਪਿੱਠ ਦੇ ਦਰਦ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਆ ਜਾਂਦਾ ਹੈ ਮਣਕੇ ਮਟਕਾਉਣੇ ਇਹ ਵੀ ਦੋ ਤਿੰਨ ਤਰੀਕੇ ਨਾਲ਼ ਹੁੰਦੇ ਹੈ ਇੱਕ ਤਾਂ ਹੁੰਦਾ ਵੀ ਬੰਦੇ ਨੂੰ ਮੁੱਧਾ ਪਾ ਕੇ ਗੂਠਿਆਂ ਨਾਲ ਦੱਬ ਕੇ ਮੋਢਿਆਂ ਕੋਲ ਅਤੇ ਥੱਲੇ ਤੱਕ ਦੱਬਦੇ ਹੋਏ ਇੱਦਾਂ ਮਟਕਾਉਣੇ ਇੱਕ ਤਰੀਕਾ ਹੁੰਦਾ ਹੈ ਕਿ ਬੰਦੇ ਨੂੰ ਸਿੱਧਾ ਖੜ੍ਹਾ ਕਰਕੇ ਫਿਰ ਉਹਦੇ ਹੱਥ ਆਪਸ ਦੇ ਵਿੱਚ ਦੋਵੇਂ ਲੌਕ ਕਰਕੇ ਗਰਦਨ 'ਤੇ ਰਖਾ ਕੇ ਅਤੇ ਕੂਣੀਆਂ ਮੂਹਰੇ ਕਰ ਦੇਣੀਆਂ ਛਾਤੀ ਨਾਲ ਲਗਾ ਦੇਣੀਆਂ ਅਤੇ ਫਿਰ ਪਿੱਛੋਂ ਦੂਜਾ ਬੰਦਾ ਕੂਣੀਆਂ ਬਾਹਾਂ ਨੂੰ ਆਪਣੀ ਬੁੱਕਲ 'ਚ ਭਰ ਕੇ ਅਤੇ ਬੰਦੇ ਨੂੰ ਉੱਪਰ ਨੂੰ ਚੱਕ ਕੇ ਪਿੱਠ ਮਟਕਾ ਦਿੰਦਾ ਹੈ ਉਹ ਤੋਂ ਇਲਾਵਾ ਫਿਰ ਮਾਲਸ਼ ਵੀ ਹੋ ਜਾਂਦੀ ਹੈ ਵੀ ਜਿਵੇਂ ਹੁਣ ਵੀ ਪਿੱਠ ਪੁੱਠ ਦੀ ਮਾਲਿਸ਼ ਵੀ ਕਰ ਦਿੰਦੇ ਹੈ ਬਾਕੀ ਪਹਿਲੇ ਟਾਇਮਾਂ 'ਚ ਸਿਆਣੇ ਹੁੰਦੇ ਤੇ ਪਿੰਡ 'ਚ ਬਜ਼ੁਰਗ ਬਥੇਰੇ ਇਹੋ ਜਿਹੇ ਤੇ ਜਿਨ੍ਹਾਂ ਨੇ ਮਾਲਿਸ਼ਾਂ ਮੂਲਸ਼ਾਂ ਕਰ ਦੇਣੀਆਂ ਉਹ ਤੋਂ ਇਲਾਵਾ ਹੋਰ ਵੀ ਕਈ ਤਰੀਕਿਆਂ ਨਾਲ ਪਿੱਠਾਂ ਪੂਠਾਂ ਮਟਕਾ ਦੇਣੀਆਂ ਜਿਵੇਂ ਕਿ ਇੱਕ ਬਾਹਾਂ ਦੇ ਵਿੱਚ ਨਾ ਪਿੱਠ ਨੂੰ ਪਿੱਠ ਲਗਾ ਕੇ ਬਾਹਾਂ 'ਚ ਬਾਹਾਂ ਪਾ ਕੇ ਇੱਕ ਦੂਜੇ ਪਾਸੇ ਨੂੰ ਚੱਕ ਦਿੰਦੇ ਹੈ ਉੱਕਣ ਵੀ ਜਾਣੀ ਕੇ ਵੀ ਪਿੱਠ ਦੇ ਦਰਦ ਤੋਂ ਰਾਹਤ ਮਿਲ ਜਾਂਦੀ ਹੈ